ਭਾਰਤ ਦੇਸ਼ ਦੇ ਵਿੱਚ ਬਹੁਤ ਰਾਜੇ ਹੋਏ ਹਨ ਰਾਜਿਆਂ ਮਹਾਰਾਜਿਆਂ ਦਾ ਦੇਸ਼ ਹੀ ਰਿਹਾ ਹੈ ਇਹ ਪ੍ਰਾਚੀਨ ਕਾਲ ਵਿੱਚ ਇੱਥੇ ਜਿਹੜੇ ਮੇਨ ਰਾਜੇ ਸੀ ਉਹ ਸੀ ਰਾਜਾ ਹਰੀਸ਼ ਚੰਦਰ ਚੰਦਰਗੁਪਤ ਮੋਰੀਆ ਰਾਜਾ ਬਿਕਰਮਾ ਅਦਿੱਤੇ ਰਾਜਾ ਹਰਸ਼ਵਰਧਨ ਰਾਜਾ ਪੋਰਸ ਅਤੇ ਰਾਜਾ ਅਸ਼ੋਕ ਰਾਜਾ ਦਸ਼ਰਥ ਮਹਾਰਾਣਾ ਪ੍ਰਤਾਪ ਅਲਾਉਦੀਨ ਖਿਲਜ਼ੀ ਇਹਨਾਂ ਦੇ ਬਾਰੇ ਇਤਿਹਾਸ ਵਿੱਚ ਸਾਨੂੰ ਪੜ੍ਹਾਇਆ ਜਾਂਦਾ ਹੈ ਅਤੇ ਉਸ ਦੇ ਬਾਅਦ ਮੱਧੇ ਕਾਲੀਨ ਦੇ ਵਿੱਚ ਵੀ ਸਾਨੂੰ ਜਿਹੜੇ ਰਾਜੇ ਇੱਥੇ ਆਏ ਉਹ ਉਹ ਜੋ ਸਮਾਂ ਸੀਗਾ ਜਿਹੜਾ ਕਿ ਮੁਗਲ ਕਾਲ ਸੀਗਾ ਉਦੋਂ ਇੱਥੇ ਮੁਗਲਾਂ ਦਾ ਰਾਜ ਹੋਇਆ ਅਤੇ ਮੁਗਲਾਂ ਦੇ ਰਾਜਿਆਂ ਦੇ ਵਿੱਚ ਬਾਬਰ ਹੰਮਾਯੂ ਸ਼ੇਰ ਸ਼ਾਹ ਸੂਰੀ ਅਕਬਰ ਜਹਾਂਗੀਰ ਸ਼ਾਹ ਜਹਾਂ ਔਰੰਗਜ਼ੇਬ ਬਹਾਦਰ ਸ਼ਾਹ ਜਫ਼ਰ ਇਬ੍ਰਾਹੀਮ ਲੋਧੀ ਅਤੇ ਆਪਣਾ ਬਹਾਦੁਰ ਸ਼ਾਹ ਜਫ਼ਰ ਅਤੇ ਇਹਨਾਂ ਵਿੱਚੋਂ ਦੀ ਅਕਬਰ ਨੇ ਸਭ ਤੋਂ ਲੰਬੇ ਸਮੇਂ ਤੱਕ ਇੱਥੇ ਰਾਜ ਕੀਤਾ ਉਸਨੇ ਕਰੀਬ ਇੱਥੇ ਪੰਜਾਹ ਸਾਲ ਤੱਕ ਰਾਜ ਕੀਤਾ ਅਤੇ ਉਸਨੇ ਆਪਣਾ ਇੱਕ ਅਲੱਗ ਧਰਮ ਵੀ ਚਲਾਇਆ ਸੀ ਦੀਨੇ ਇਲਾਹੀ ਨਾਮ ਦੇ ਉੱਤੇ ਅਤੇ ਇਹ ਰਾਜਾ ਜਿਹੜਾ ਅਕਬਰ ਸੀਗਾ ਇਹ ਸਾਰੇ ਧਰਮਾਂ ਨੂੰ ਮੰਨਣ ਵਾਲਾ ਸੀਗਾ ਅਤੇ ਉਸਦੇ ਬਾਅਦ ਆਪਣੇ ਜਿਹੜੇ ਇਹਨਾਂ ਦੇ ਹੋਰ ਰਾਜੇ ਹੋਏ ਹਨ ਉਹਨਾਂ ਤੋਂ ਇਲਾਵਾ ਇੱਕ ਹੈਦਰਾਬਾਦ ਦੇ ਵਿੱਚ ਹੋਇਆ ਜਿਹੜਾ ਕਿ ਤੈਮੂਰ ਸੀਗਾ ਅਤੇ ਉਸਨੇ ਵੀ ਉੱਥੇ ਜਾ ਕੇ ਰਾਜ ਕੀਤਾ